ਮੈਂ ਔਨਲਾਈਨ ਸ਼ੋਪਿੰਗ ਕਰਦਾ ਹੀ ਰਹਿੰਦਾ ਹਾਂ ਮੈਂ ਜ਼ਿਆਦਾਤਰ ਐਮਾਜੋਨ ਤੋਂ ਸ਼ੋਪਿੰਗ ਕਰਦਾ ਹਾਂ ਉਹਨਾਂ ਦੀ ਸਰਵਿਸ ਬਹੁਤ ਹੀ ਵਧੀਆ ਹੈ ਜੋ ਵੀ ਟਾਈਮ ਉਹਨਾਂ ਨੇ ਦੱਸਿਆ ਹੁੰਦਾ ਹੈ ਉਹ ਉਸੇ ਟਾਈਮ 'ਤੇ ਦੇ ਸਮਾਨ ਦੇ ਜਾਂਦੇ ਹਨ ਉਹਨਾਂ ਦੇ ਡਿਲੀਵਰੀ ਬੋਆਏ ਵੀ ਬਹੁਤ ਚੰਗੇ ਵਿਹਾਰ ਕਰਨ ਵਾਲੇ ਹਨ ਸਹੀ ਸਮਾਨ ਪਹੁੰਚਾ ਦਿੰਦੇ ਹਨ ਮੈਂ ਐਮਾਜ਼ੋਨ ਤੋਂ ਮੋਬਾਇਲ ਮੰਗਵਾਇਆ ਸੀ ਉਹ ਬਹੁਤ ਹੀ ਵਧੀਆ ਰਿਹਾ ਬਹੁਤ ਵਧੀਆ ਚੱਲਦਾ ਹੈ ਗਰਮ ਨਹੀਂ ਹੋਇਆ ਕਦੀ ਗਰਮ ਨਹੀਂ ਹੋਇਆ ਨਾ ਕਦੀ ਹੈਂਗ ਹੀ ਹੋਇਆ ਹੈ ਨਾ ਹੀ ਕਦੀ ਹੈਂਗ ਹੋਇਆ ਇਸ ਦਾ ਇਸ ਦੀ ਬੈਟਰੀ ਬੈਕਅੱਪ ਵੀ ਬਹੁਤ ਵਧੀਆ ਹੈ